ਪੰਜਾਬ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਅਤੇ ਜਦਕਿ ਭਾਰਤ ਵਿੱਚ ਬਾਕੀ ਸਟੇਟਾਂ ਵਿੱਚ ਹਿੰਦੀ ਚੱਲਦੀ ਹੈ ਲੇਕਿਨ ਮਤਲਬ ਕਈ ਵਾਰੀ ਸੇਮ ਹੀ ਹੁੰਦੇ ਪੰਜਾਬੀ ਦੇ ਹੀ ਮਤਲਬ ਜੋ ਬੋਲਾਂਗੇ ਜਾਂ ਹਿੰਦੀ ਵਿੱਚ ਪੰਜਾਬੀ ਜਿਸ ਤਰ੍ਹਾਂ ਕਹਾਂਗੇ ਬਈ ਇਧ ਇੱਧਰ ਆ ਹਿੰਦੀ ਵਿੱਚ ਕਹਾਂਗੇ ਈਧਰ ਆਓ ਮਤਲਬ ਤਾਂ ਸੇਮ ਹੈ ਲੇਕਿਨ ਬੋਲਣ ਦਾ ਸਟਾਈਲ ਅਤੇ ਬੋਲਣ ਦੇ ਵਿੱਚ ਅਲੱਗ ਅਲੱਗ ਹੁੰਦਾ ਹੈ ਇਸ ਤਰ੍ਹਾਂ ਵੈਸੇ ਤਾਂ ਹਿੰਦੀ ਅਗਰ ਪੰਜਾਬ ਤਾਂ ਸਾਰੇ ਪੰਜਾਬੀ 'ਚ ਪੰਜਾਬ 'ਚ ਚੱਲੇਗੀ ਪੰਜਾਬੀ ਅਗਰ ਉਹ ਹੀ ਬੰਦਾ ਹਿੰਦੀ ਸਿੱਖ ਲਵੇ ਹਿੰਦੀ ਹੋਵੇ ਤਾਂ ਉਹ ਹਿੰਦੀ ਸਾਰੇ ਜਿੱਥੇ ਵੀ ਹੋਰ ਕਿਤੇ ਕੰਮ ਪਵੇ ਕਿਸੇ ਵੀ ਸਟੇਟ 'ਚ ਜਾਵੇ ਤਾਂ ਉਹਨੂੰ ਇਸ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਵੇਗੀ ਕਿਉਂਕਿ ਹਿੰਦੀ ਬੋਲ ਕੇ ਉਹ ਆਪਣਾ ਗੁਜ਼ਾਰਾ ਆਪਣਾ ਕੰਮ ਚਲਾ ਸਕਦਾ ਹੈ ਇਸ ਪਿੱਛੇ ਜ਼ਿਆਦਾਤਰ ਬੰਦੇ ਨੂੰ ਪੰਜਾਬ ਹਿੰਦੀ ਸਿੱਖਣੀ ਚਾਹੀਦੀ ਹੈ ਪੰਜਾਬ ਨੇ ਸਿਰਫ਼ ਪੰਜਾਬੀ ਨੇ ਸਿਰਫ਼ ਪੰਜਾਬ 'ਚ ਕੰਮ ਕਰਨਾ ਹੈ ਹਿੰਦੀ ਸਿੱਖੀ ਹੋਈ ਹੋਵੇ ਤਾਂ ਉਹਨੇ ਸਾਰੇ ਸਟੇਟਾਂ ਵਿੱਚ ਹਰ ਜਗ੍ਹਾ ਕੰਮ ਕਰੇਗੀ ਇਸ ਤਰ੍ਹਾਂ ਭਾਸ਼ਾ ਭਾਰੇ ਭਾਰਤ ਹਿੰਦੀ ਨਾਲ ਤੁਲਨਾ ਕਰਦੀ ਹੈ ਇਸ ਤਰ੍ਹਾਂ ਦੋਨੇ ਭਾਸ਼ਾ ਚਲੋ ਵੱਧ ਤੋਂ ਵੱਧ ਭਾਸ਼ਾ ਸਿੱਖਣੀ ਚਾਹੀਦੀ ਉਹਦੇ ਕੋਈ ਵੀ ਭਾਸ਼ਾ ਵੱਧ ਤੋਂ ਵੱਧ ਸਿੱਖਣੀ ਚਾਹੀਦੀ ਹੈ ਅਤੇ ਹਰ ਇੱਕ ਭਾਸ਼ਾ ਦਾ ਆਪਣਾ ਆਪਣਾ ਸਥਾਨ ਹੈ ਮਿਹਰਬਾਨੀ